ਪੌਦਿਆਂ ਨੂੰ ਸਭ ਤੋਂ ਪਹਿਲਾਂ ਤਾਂ ਪੌਦਿਆਂ ਦੀ ਅਸੀਂ ਦੇਖਭਾਲ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਾਂ ਉਹ ਕਿਵੇਂ ਕਿ ਹੈ ਨਾ ਪਹਿਲਾਂ ਤਾਂ ਪੌਦਿਆਂ ਨੂੰ ਅਸੀਂ ਮੌਸਮ ਦੇ ਅਨੁਸਾਰ ਉਹਨੂੰ ਪਾਣੀ ਦਿੰਦੇ ਹਾਂ ਅਤੇ ਜੇ ਠੰਡ ਗਰਮੀ ਦੇ ਹਿਸਾਬ ਨਾਲ ਮੌਸਮਾਂ ਪੌਦਿਆਂ ਨੂੰ ਇੱਧਰ ਤੋਂ ਉੱਧਰ ਪਹੁੰਚਾਉਂਦੇ ਹਾਂ ਤਾਂ ਕਿ ਜੋ ਉਹਨਾਂ ਨਾਲ ਉਹਨਾਂ ਦੀ ਪੌਦਿਆਂ ਦੀ ਗਰੋਥ ਹੁੰਦੀ ਰਹੇ ਜੇਕਰ ਆਪਾਂ ਹੈ ਨਾ ਅਤੇ ਦੂਸਰਾ ਪਾਣੀ ਉਹਨਾਂ ਨੂੰ ਟਾਈਮ ਸਿਰ ਦਿੰਦੇ ਹਾਂ ਅਤੇ ਉਹਨਾਂ ਨੂੰ ਠੰਡ ਹਵਾ ਦੀ ਵੀ ਦੇਖ ਰੇਖ ਪੂਰੀ ਕਰਦੇ ਹਾਂ ਪੌਦਿਆਂ ਨੂੰ ਬਚਾਉਣ ਲਈ ਉਹਨਾਂ ਦੇ ਵਿੱਚ ਹਰੇ ਖਾਦ ਪਦਾਰਥ ਜੋ ਵੀ ਉਹਨਾਂ ਨੂੰ ਜਿੰਨੀ ਮਾਤਰਾ ਦੇ ਵਿੱਚ ਲੋੜ ਹੁੰਦੀ ਆ ਓਨੀ ਮਾਤਰਾ ਦੇ ਵਿੱਚ ਉਹਨਾਂ ਨੂੰ ਪਹੁੰਚਾਇਆ ਜਾਂਦਾ ਹੈ ਤਾਂ ਕਿ ਜੋ ਪੌਦੇ ਵੱਧ ਫੁੱਲ ਸਕਣ ਜਿਸ ਨਾਲ ਪੌਦਿਆਂ ਦੀ ਬਣਤਰ ਵੀ ਵਧੀਆ ਆ ਸਕੇ ਜੇ ਅਤੇ ਪੌਦਿਆਂ ਦੀ ਦੇਖ ਰੇਖ ਕਰਨ ਲਈ ਪੌਦਿਆਂ ਨੂੰ ਪਾਣੀ ਦੇਣਾ ਉਹਨਾਂ ਦੀ ਦੇਖ ਰੇਖ ਕਰਨੀ ਉਹਨਾਂ ਦੀ ਕਟਿੰਗ ਟਾਈਮ ਸਿਰ ਕਰਨੀ ਜਿਸ ਨਾਲ ਪੌਦਿਆਂ ਦੀ ਗਰੋਥ ਸੁੰਦਰਤਾ ਹੋਰ ਜ਼ਿਆਦਾ ਨਿਖਰ ਕੇ ਆਉਂਦੀ ਹੈ ਅਤੇ ਪਾਣੀ ਦੇਣ ਨਾਲ ਪਾਣੀ ਦੇਣਾ ਪੌਦਿਆਂ ਦੀ ਦੇਖ ਰੇਖ ਕਰਨੀ ਉਹਨਾਂ ਕੱਟਣਾ ਵੱਢਣਾ ਸਾਰਾ ਟਾਈਮ ਸਿਰ ਕੀਤਾ ਜਾਂਦਾ ਹੈ ਜੇਕਰ ਪਾ ਪੌਦਿਆਂ ਨੂੰ ਪਾਣੀ ਦੇ ਵਿੱਚ ਜ਼ਿਆਦਾ ਰੱਖੀਏ ਜਾਂ ਉਹਨਾਂ ਨੂੰ ਹਵਾ ਦੇ ਵਿੱਚ ਧੁੱਪ 'ਚ ਜ਼ਿਆਦਾ ਰੱਖੀਏ ਤਾਂ ਉਹ ਸੜ ਜਾਣਗੇ ਜਿਸ ਨਾਲ ਉਹਨਾਂ ਧੁੱਪ ਅਤੇ ਛਾਵਾਂ ਦੀ ਵੀ ਬਰਾਬਰ ਦੀ ਹਵਾ ਦਿੱਤੀ ਜਾਂਦੀ ਹੈ ਅਤੇ ਪਾਣੀ ਵੀ ਬਾ ਬਰਾਬਰ ਮਾਤਰਾ ਵਿੱਚ ਦਿੱਤਾ ਜਾਂਦਾ ਤਾਂ ਜੋ ਉਹ ਟਾਈਮ ਸਿਰ ਵੱਧ ਫੁੱਲ ਸਕਣ